ਅਗਰ ਮੈਂ ਇੱਕ ਯਾਦਗਾਰ ਜਾਂ ਚੁਣੌਤੀਪੂਰਵਕ ਗਾਇਕੀ ਅਨੁਭਵ ਦਾ ਵਰਨਣ ਕਰਨਾ ਚਾਹਵਾਂ ਤਾਂ ਮੈਂ ਦੱਸਣਾ ਚਾਹੂੰਗਾ ਕਿ ਮੈਂ ਆਪਣੇ ਕਾਲਜ ਦੇ ਵਿੱਚ ਹੀ ਔਡੀਸ਼ਨ ਦੇਣ ਗਿਆ ਸੀ ਆਪਣੇ ਗਾਇਕੀ ਦਾ ਉੱਥੇ ਕੰਪਟੀਸ਼ਨ ਸੀਗਾ ਉਹਦੇ ਲਈ ਉਹ ਗਾਉਣਾ ਸੀ ਅਤੇ ਉਹਦੀ ਔਡੀਸ਼ਨਾਂ ਸਨ ਅਤੇ ਉਹਦੇ ਵਿੱਚ ਮੈਨੇ ਆਪਣਾ ਬੈਸਟ ਦਿੱਤਾ ਅਤੇ ਹਲਾਂਕਿ ਮੈਂ ਉੱਥੇ ਸਲੈਕਟ ਨਹੀਂ ਹੋ ਪਾਇਆ ਪਰ ਮੇਰੇ ਹਿਸਾਬ ਨਾਲ ਉਹ ਮੇਰੇ ਲਈ ਇੱਕ ਯਾਦਗਾਰ ਐਕਸਪੀਰੀਅੰਸ ਸੀਗਾ ਜਿਹੜਾ ਕਿ ਮੈਨੂੰ ਯਾਦ ਰਹੇ ਕਿਉਂਕਿ ਮੈਂ ਇੱਕ ਹਿੰਮਤ ਕੀਤੀ ਆਪਣੇ ਵੱਲੋਂ ਅਤੇ ਅੱਗੇ ਗਿਆ ਲੇਕਿਨ ਉਸ ਤੋਂ ਬਾਅਦ ਇਹ ਮੇਰੀ ਅਤੇ ਮੈਂ ਜਦ ਵੀ ਮੈਨੂੰ ਮੌਕਾ ਮਿਲੇਗਾ ਮੈਂ ਦੁਬਾਰਾ ਤੋਂ ਗਾਇਕੀ ਦੇ ਕੰਪੀਟੀਸ਼ਨਾਂ ਵੱਲ ਜਾਣ ਦੀ ਸੋਚਾਂਗਾ